ਵੀਹ ਅਠਾਈ ਜੂਨ ਦੋ ਹਜ਼ਾਰ ਚੌਵੀ ਪੰਦਰਾਂ ਅਗਸਤ ਦੋ ਹਜ਼ਾਰ ਵੀਹ ਪੱਚੀ ਜਨਵਰੀ ਦੋ ਹਜ਼ਾਰ ਦਸ ਦਸ ਅਕਤੂਬਰ ਦੋ ਹਜ਼ਾਰ ਪੰਦਰਾਂ ਨੌਂ ਫਰਵਰੀ ਦੋ ਹਜ਼ਾਰ ਤੀਹ